ਵੈਸੇ ਤਾਂ ਸਾਰੀਆਂ ਭਾਸ਼ਾਵਾਂ ਬਾਰੇ ਗਲਤ ਧਾਰਨਾਵਾਂ ਸੁਣਨ ਵਿੱਚ ਆਉਂਦੀਆਂ ਹਨ ਇਸ ਤਰ੍ਹਾਂ ਪੰਜਾਬੀ ਭਾਸ਼ਾ ਬਾਰੇ ਵੀ ਬਹੁਤ ਸਾਰੀਆਂ ਧਾਰਨਾਵਾਂ ਪ੍ਰਚਲਿਤ ਹਨ ਜੋ ਪੰਜਾਬੀ ਭਾਸ਼ਾ ਹੈ ਉਹ ਭਾਰਤ ਦੀਆਂ ਸੰਵਿਧਾਨਿਕ ਭਾਸ਼ਾਵਾਂ ਵਿੱਚ ਦਰਜ ਹੈ ਪੰਜਾਬੀ ਦੀ ਇਹ ਰਾਜ ਭਾਸ਼ਾ ਹੈ ਪੰਜਾਬੀ ਭਾਸ਼ਾ ਬਾਰੇ ਗਲਤ ਧਾਰਨਾ ਇਹ ਬਣਾਈ ਜਾਂਦੀ ਹੈ ਕਿ ਇਹ ਇੰਟਰਨੈਟ ਦੀ ਭਾਸ਼ਾ ਨਹੀਂ ਬਣ ਸਕਦੀ ਪਰ ਜੋ ਭਾਸ਼ਾ ਦੇ ਖੇਤਰ ਵਿੱਚ ਖੋਜ ਹੋ ਰਹੀ ਹੈ ਉਹਨਾਂ ਵਿੱਚ ਸਾਬਿਤ ਹੋ ਚੁੱਕਿਆ ਹੈ ਕਿ ਪੰਜਾਬੀ ਭਾਸ਼ਾ ਇੰਟਰਨੈੱਟ ਦੀ ਭਾਸ਼ਾ ਬਣ ਸਕਦੀ ਹੈ ਇਸ ਲਈ ਪੰਜਾਬੀ ਭਾਸ਼ਾ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਰੋਜ਼ਗਾਰ ਦੀ ਭਾਸ਼ਾ ਨਹੀਂ ਹੈ ਪਰ ਜੇਕਰ ਅਸੀਂ ਚੰਗੇ ਢੰਗ ਨਾਲ ਉਚਾਰਣ ਪੰਜਾਬੀ ਭਾਸ਼ਾ ਦੀ ਸਿੱਖਿਆ ਗ੍ਰਹਿਣ ਕਰਦੇ ਹਾਂ ਤਾਂ ਸਾਨੂੰ ਰੋਜ਼ਗਾਰ ਵਿੱਚ ਬਹੁਤ ਮੌਕੇ ਮਿਲਦੇ ਹਨ ਅੱਜ ਕੱਲ੍ਹ ਤਾਂ ਇਹ ਸਿੱਧ ਹੋ ਰਿਹਾ ਹੈ ਕਿ ਪੰਜਾਬੀ ਦੀ ਸਿੱਖਿਆ ਵੱਧ ਤੋਂ ਵੱਧ ਗ੍ਰਹਿਣ ਕੀਤੀ ਜਾ ਰਹੀ ਹੈ ਪੰਜਾਬੀ ਦੀ ਪੀ ਐੱਚ ਡੀ ਵਿੱਚ ਵੀ ਬਹੁਤ ਵਿਦਿਆਰਥੀ ਦਾਖਲਾ ਲੈ ਰਹੇ ਹਨ ਪੰਜਾਬੀ ਭਾਸ਼ਾ ਦੀ ਟਾਈਪਿੰਗ ਪ੍ਰਤੀ ਵੀ ਬਹੁਤ ਮੰਗ ਕੀਤੀ ਜਾਣ ਲੱਗੀ ਹੈ